ਖਾਣਾ ਬਣਾਉਣਾ ਔਰਤਾਂ ਦਾ ਹੀ ਕੰਮ ਨਹੀਂ ਸਗੋਂ ਮਰਦਾਂ ਨੂੰ ਵੀ ਬਣਾਉਣਾ ਚਾਹੀਦਾ ਹੈ ਜੇ ਅਗਰ ਜੇ ਕਿਤੇ ਕੋਈ ਔਰ ਘਰ ਵਿੱਚ ਔਰਤ ਬਿਮਾਰ ਹੋ ਜਾਵੇ ਤਾਂ ਮਰਦ ਖਾਣਾ ਬਣਾ ਸਕਣ ਇਸ ਤਰ੍ਹਾਂ ਇਸ ਇੱਕ ਦੂਸਰੇ ਦੀ ਹੈਲਪ ਕੀਤੀ ਜਾ ਸਕਦੀ ਹੈ ਅਤੇ ਸਾਡੀ ਜ਼ਿੰਦਗੀ ਜਿਹੜੀ ਆ ਉਹ ਅਸਾਨੀ ਨਾਲ ਬਤੀਤ ਹੁੰਦੀ ਹੈ ਸਾਨੂੰ ਕਿਸੇ 'ਤੇ ਡਿਪੈਂਡ ਨਹੀਂ ਹੋਣਾ ਪੈਂਦਾ ਹਾਂ ਮੇਰੇ ਘਰ ਵਿੱਚ ਮੇਰੇ ਹਸਬੈਂਡ ਔਰ ਮੇਰੇ ਪਾਪਾ ਵੀ ਦੋਨੋਂ ਖਾਣਾ ਬਣਾਉਂਦੇ ਹਨ ਔਰ ਉਹ ਬਹੁਤ ਹੀ ਵਧੀਆ ਬਣਾਉਂਦੇ ਹਨ ਮੇਰੇ ਬੱਚੇ ਉਹਨਾਂ ਦਾ ਖਾਣਾ ਬਹੁਤ ਪਸੰਦ ਕਰਦੇ ਹਨ